ਸਥਾਨਕ ਮਨੋਰੰਜਨ ਦੇ ਵਿੱਚ ਅਸੀਂ ਗੱਲ ਕਰੀਏ ਤਾਂ ਰੂਪਨਗਰ ਜ਼ਿਲ੍ਹੇ ਦੇ ਵਿੱਚ ਸਾਡੇ ਇੱਥੇ ਆਨੰਦਪੁਰ ਸਾਹਿਬ ਜਿੱਥੇ ਖਾਲਸਾ ਪੰਥ ਦਾ ਸਾਜਨਾ ਦਿਵਸ ਮਨਾਇਆ ਜਾਂਦਾ ਹਰ ਸਾਲ ਹੋਲੇ ਮਹੱਲੇ ਦੇ ਰੂਪ ਦੇ ਵਿੱਚ ਤਾਂ ਉੱਥੇ ਜਿੰਨੇ ਘੋੜ ਸਵਾਰੀ ਹੋਣੀ ਆ ਜਾਂ ਯੁੱਧ ਅਭਿਆਸ ਦੇ ਵਿੱਚ ਯੁੱਧ ਲੜਨ ਦੇ ਵਾਸਤੇ ਜੋ ਕੁਛ ਨਿਹੰਗਾਂ ਨੂੰ ਆਉਣਾ ਚਾਹੀਦਾ ਹੈ ਉਹਨਾਂ ਦੀ ਇੱਕ ਤਰ੍ਹਾਂ ਦੀ ਉੱਥੇ ਅਭਿਆਸ ਕਰਾਇਆ ਜਾਂਦਾ ਹੈ ਅਤੇ ਅਸਲ ਦੇ ਵਿੱਚ ਉਹ ਖੇਡ ਦੇ ਰੂਪ ਵਿੱਚ ਲੋਕਾਂ ਨੂੰ ਦਿਖਾਇਆ ਜਾਂਦਾ ਹੈ ਅਤੇ ਘੋੜ ਸਵਾਰੀ ਉਹਦੇ 'ਚ ਸਭ ਤੋਂ ਜ਼ਿਆਦਾ ਖਾਸ ਹੈ ਜਿਹਦੇ 'ਚ ਕਈ ਕਈ ਤਰ੍ਹਾਂ ਦੇ ਕਰਤੱਬ ਉਹ ਕਰਦੇ ਹੈ ਅਤੇ ਬੜੇ ਔਖੇ ਕਰਤੱਬ ਕਰਦੇ ਹੈ ਅਤੇ ਸਾਲ ਦੇ ਅਖੀਰ ਦੇ ਵਿੱਚ ਸਾਹਿਬਜ਼ਾਦਿਆਂ ਦੇ ਸ਼ਹੀਦੀਆਂ ਦੇ ਦਿਨ ਆ ਜਾਂਦੇ ਆ ਜਿਹਨਾਂ ਦੇ ਵਿੱਚ ਜਿਹਨੂੰ ਸਭਾ ਦੇ ਟਾਈਮ ਬੋਲਿਆ ਜਾਂਦਾ ਸਭਾ ਦੇ ਦਿਨ ਬੋਲਿਆ ਜਾਂਦਾ ਹੈ ਉਹ ਪਰਿਵਾਰ ਵਿਛੋੜਾ ਸਾਹਿਬ ਤੋਂ ਸ਼ੁਰੂ ਹੋ ਕੇ ਫਤਿਹਗੜ੍ਹ ਸਾਹਿਬ ਗੁਰਦੁਆਰਾ ਦੇ ਵਿੱਚ ਚਰਨ ਕਮਲ ਵਿੱਚ ਜਾ ਕੇ ਖ਼ਤਮ ਹੁੰਦਾ ਹੈ ਅਤੇ ਉਹ ਸੋਗ ਦੇ ਦਿਨ ਹੁੰਦੇ ਹੈ ਪੰਜਾਬ ਦੇ ਲਈ ਹਾਂ ਖਾ ਜੇ ਦੱਸਿਆ ਜਾਵੇ ਉਹਨਾਂ ਨੂੰ ਵੀ ਸਮਝਾਉਣਾ ਹੈ ਪਈ ਅਤੇ ਆਹੀ ਕੁਛ ਹੈਗਾ ਰੋਪੜ ਦੇ ਵਿੱਚ ਚਲਦਾ ਹੈਗਾ